ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਭਾਅ ਜੀ ਪੰਜਾਬ ਤੋਂ ਬੋਲਦਾ ਹਾਂਜੀ ਭਾਅ ਜੀ ਬੋਲੋ ਹਾਂਜੀ ਹਾਂਜੀ ਹਾਂਜੀ ਭਾਅ ਜੀ ਜਾ ਸਕਦੇ ਹੋ ਭਾਅ ਜੀ ਜ ਜਾਂ ਪੰਜਾਬ 'ਚ ਗੁਰਦੁਆਰੇ ਘੁੰਮਣਾ ਭਾਅ ਜੀ ਗੁਰਦੁਆਰਾ ਅੰਮ੍ਰਿਤਸਰ ਅਨੰਦਪੁਰ ਸਾਹਿਬ ਭੱਠਾ ਸਾਹਿਬ ਟਿੱਬੀ ਸਾਹਿਬ ਹਾਂਜੀ ਆ ਹਾਂਜੀ ਬਈ ਸਾਡਾ ਰੇਟ ਤਾਂ ਜੀ ਦਸ ਹਜ਼ਾਰ ਰੁਪਇਆ

ਹਾਂਜੀ ਭਾਅ ਜੀ ਕੋਈ ਨਾ ਅੱਠ ਹਜ਼ਾਰ ਦੇ ਦੇਵਾਂਗੇ ਤੁਹਾਨੂੰ ਹਾਂਜੀ ਭਾਅ ਜੀ ਘੁੰਮਾ ਦੇਵਾਂਗੇ ਸਾਰਾ ਪੰਜਾਬ ਹਾਂਜੀ ਕੋਈ ਵੀ ਜਾ ਸਕਦਾ ਮੈਂ ਤੁਹਾਨੂੰ ਦੱਸਿਆ ਅੰਮ੍ਰਿਤਸਰ ਅਨੰਦਪੁਰ ਸਾਹਿਬ ਹਾਂ ਵਧੀਆ ਵਧੀਆ ਗੁਰਦੁਆਰੇ ਜਲ੍ਹਿਆਂਵਾਲਾ ਬਾਗ ਹਾਂਜੀ ਚਿੜੀਆ ਘਰ ਬਾਰੇ ਵੀ ਤਾਂ ਘੁੰਮਾ ਲਿਆਂਉਦੇ ਤੁਹਾਨੂੰ ਹਾਂ ਨੰਗਲ ਡੈਮ ਦਿਖਾਵਾਂਗੇ ਭਾਅ ਜੀ

ਹਾਂਜੀ ਹਾਂਜੀ ਭਾਅ ਜੀ ਘੁੰਮਾ ਦੇਵਾਂਗੇ ਪੰਜਾਬ ਹਾਂਜੀ ਹਾਂਜੀ ਭਾਅ ਜੀ ਮੈਂ ਕਰ ਦਿੰਦਾ ਵੱਟਸਐਪ 'ਤੇ ਤੁਹਾਨੂੰ ਠੀਕ ਹੈ ਭਾਅ ਜੀ ਬਾਏ ਬਾਏ ਓਕ